ਜਦੋਂ ਹੀ ਅਸੀਂ ਕਿਤੇ ਬਾਹਰ ਚਲੇ ਜਾਂਦੇ ਹਾਂ ਅਤੇ ਸਾਡੇ ਜਿਹੜੇ ਬੂਟੇ ਜਿਹੜੇ ਪੌਦੇ ਬਗੀਚੇ ਵਿੱਚ ਲੱਗੇ ਹਨ ਉਨ੍ਹਾਂ ਦੀ ਦੇਖਭਾਲ ਲਈ ਅਸੀਂ ਆਪਣੇ ਘਰ ਦੇ ਜਾਂ ਤਾਂ ਨਾਲ਼ ਵਾਲ਼ੇ ਕਿਸੇ ਗਵਾਂਢੀ ਨੂੰ ਕਹਿ ਜਾਂਦੇ ਹਾਂ ਕਿਉਂਕਿ ਜੇ ਅਸੀਂ ਜਾਂਦੇ ਹਾਂ ਤਾਂ ਸਾਰੇ ਘਰਦੇ ਇਕੱਠੇ ਜਾਂਦੇ ਹਾਂ ਤਾਂ ਸਾਡੇ ਜਿਹੜੇ ਨਾਲ਼ ਦੇ ਗਵਾਂਢੀ ਆ ਉਨ੍ਹਾਂ ਨੂੰ ਪੌਦਿਆਂ ਨੂੰ ਸੁਬਹ ਸ਼ਾਮ ਦੇ ਵਿੱਚ ਟਾਈਮ ਦੇ ਵਿੱਚ ਪਾਣੀ ਦੇ ਦਿੰਦੇ ਹਨ ਤਾਂ ਕਿ ਉਹ ਪੌਦੇ ਮੁਰਝਾ ਨਾ ਸਕਣ ਕਿਉਂਕਿ ਜਿਹੜੇ ਅਸੀਂ ਆਪਣੇ ਬਗੀਚੇ ਵਿੱਚ ਪੌਦੇ ਲਗਾਏ ਹਨ ਉਹ ਬਹੁਤ ਹੀ ਅ ਸਾਡੇ ਲਈ ਬਹੁਤ ਜ਼ਿਆਦਾ ਪਿਆਰੇ ਹਨ ਕਿਉਂਕਿ ਸਾਨੂੰ ਉਹ ਇੱਕ ਸਾਡੇ ਪਰਿਵਾਰ ਦਾ ਹਿੱਸਾ ਲੱਗਦਾ ਹੈ ਕਿਉਂਕਿ ਉਨ੍ਹਾਂ ਦੇ ਨਾਲ਼ ਹੀ ਅਸੀਂ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਾਂ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਦੇ ਹਾਂ ਤਾਂ ਸਾਨੂੰ ਸਮੇਂ ਦਾ ਕੁਛ ਨਹੀਂ ਪਤਾ ਨਹੀਂ ਚੱਲਦਾ ਔਰ ਈ ਹਾਲਾਂਕਿ ਸਾਡੇ ਜੀਵਨ ਦੇ ਵਿੱਚ ਪੌਦੇ ਬਹੁਤ ਜ਼ਿਆਦਾ ਜ਼ਰੂਰੀ ਏ ਕਿਉਂਕਿ ਸਾਨੂੰ ਇਨ੍ਹਾਂ ਤੋਂ ਔਕਸੀਜਨ ਮਿਲਦੀ ਹੈ ਜੇ ਪੌਦੇ ਨਹੀਂ ਲਗਾਵਾਂਗੇ ਤਾਂ ਸਾਨੂੰ ਔਕਸੀਜਨ ਦੀ ਵੀ ਕਮੀ ਹੋਣ ਲੱਗ ਜੇਗੀ ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਵੀ ਇਹ ਹੀ ਚੀਜ਼ ਕਹਿਣਾ ਚਾਹੂੰਗੀ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਪੌਦੇ ਜ਼ਰੂਰ ਲਗਾਉਣ ਕਿਉਂਕਿ ਇਹ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਹਨ